ਬਹੁਤ ਜ਼ਿਆਦਾ ਖਰਾਬ ਮੌਸਮ ਜਿਵੇਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜਾਂ ਅ ਹਨੇਰੀ ਝੱਖੜ ਆ ਗਿਆ ਇਹਨਾਂ ਦੋਨਾਂ ਹਾਲਾਤਾਂ ਦੇ ਵਿੱਚ ਆਪਾਂ ਨੂੰ ਪੌਦਿਆਂ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਪੈਂਦਾ ਵੀ ਹੈਗਾ ਉਹਦੇ ਵਾਸਤੇ ਜਿਵੇਂ ਬਹੁਤ ਜ਼ਿਆਦਾ ਧੁੱਪ ਪੈ ਰਹੀ ਹੈ ਤਾਂ ਆਪਾਂ ਇੱਕ ਹਰੇ ਰੰਗ ਦੀ ਚਾਨਣੀ ਜੀ ਲਗਾ ਦਿੰਦੇ ਆ ਉੱਪਰ ਨੂੰ ਚਾਦਰ ਜੀ ਹੁੰਦੀ ਆ ਉਹਦੇ ਨਾਲ ਠੀਕ ਰਹਿ ਜਾਂਦਾ ਤਾਂ ਕਿ ਡਰੈਕਟ ਹੀਟ ਨਹੀਂ ਆਉਂਦੀ ਸੂਰਜ ਦੀ ਸਿੱਧੀ ਗਰਮੀ ਉੱਪਰ ਪੌਦਿਆਂ ਤੱਕ ਡਰੈਕਟਰ ਨਹੀਂ ਪਹੁੰਚਦੀ ਪਰ ਪੌਦਿਆਂ ਨੂੰ ਧੁੱਪ ਤਾਂ ਚਾਹੀਦੀ ਹੈ ਤਾਂ ਉਹਨਾਂ ਨੂੰ ਜ਼ਰੂਰੀ ਵੀ ਆ ਥੋੜ੍ਹਾ ਜਿਹਾ ਉੱਥੇ ਰੱਖਣਾ ਵੀ ਪੈਂਦਾ ਉਹਨਾਂ ਦੇ ਕੋਲ ਬਾਕੀ ਜ਼ਿਆਦਾ ਕਿਤੇ ਜਿਵੇਂ ਤੁਸੀਂ ਘਰ ਤੋਂ ਇੱਕ ਦੋ ਦਿਨ ਲਈ ਜਾਣਾ ਹੈ ਤੁਹਾਨੂੰ ਪਤਾ ਹੈ ਵੀ ਗਰਮੀ ਹੈ ਜੂਨ ਹੈ ਤਾਂ ਉਸ ਟਾਈਮ ਦੇ ਵਿੱਚ ਅਸੀਂ ਉਹਨੂੰ ਇੱਕ ਸਪੰਜ਼ ਜਾਂ ਫਿਰ ਜਿਵੇਂ ਨਾਰੀਅਲ ਦਾ ਗੁੱਦਾ ਹੁੰਦਾ ਉਹਨੂੰ ਰੱਖ ਕੇ ਉਹਨੂੰ ਗਿੱਲਾ ਕਰ ਦਿੰਦੇ ਹਾਂ ਤਾਂ ਕਾਫ਼ੀ ਦਿਨ ਤੱਕ ਨਮੀ ਓਹਦੇ ਨਾਲ ਵੱਧ ਟਾਈਮ ਤੱਕ ਨਿਕਲ ਜਾਂਦੀ ਹਾਂ ਬਾਕੀ ਜਦੋਂ ਮੀਹ ਝੱਖੜ ਹਨੇਰੀ ਹੈਗਾ ਭਾਅ ਜੀ ਮ ਫੇਰ ਤਾਂ ਬੂਟੇ ਚੱਕ ਕੇ ਆਪਾਂ ਨੂੰ ਅੰਦਰ ਹੀ ਰੱਖਣੇ ਪੈਂਦੇ ਹਾਂ ਤਾਂ ਕਿ ਉਹ ਬਚੇ ਰਹਿਣ